ਸਕੂਲ ਵਿੱਚ ਵਿਦਿਆਰਥੀਆਂ ਲਈ ਕਲਾ ਅਤੇ ਸ਼ਿਲਪਕਾਰੀ ਲਈ ਇੱਕ ਅਲੱਗ ਅਧਿਆਪਕ ਰੱਖਿਆ ਜਾਂਦਾ ਹੈ ਜੋ ਕਿ ਉਹਨਾਂ ਨੂੰ ਨਿਪੁੰਨ ਬਣਾਉਂਦਾ ਹੈ ਉਹਨਾਂ ਨੂੰ ਸਿਖਲਾਈ ਦਿੰਦਾ ਹੈ ਮੈਂ ਵੀ ਬਚਪਨ ਵਿੱਚ ਬਹੁਤ ਕਲਾਕਾਰੀ ਕੀਤੀ ਅਤੇ ਬਹੁਤ ਸਾਰੀਆਂ ਕਿਤਾਬਾਂ ਆਪਣੀ ਕਲਾਕਾਰੀ ਨਾਲ ਭਰ ਕੇ ਅੱਜ ਵੀ ਆਪਣੇ ਕਮਰੇ ਵਿੱਚ ਰੱਖੀਆਂ ਹੋਈਆਂ ਹਨ ਬਚਪਨ ਵਿੱਚ ਵੀ ਮੈਂ ਚਿੱਤਰਕਾਰੀ ਦੇ ਨਾਲ ਨਾਲ ਅਤੇ ਚਿੱਤਰਕਾਰੀ ਦੇ ਨਾਲ ਨਾਲ ਮੂਰਤੀ ਮੂਰਤੀਕਾਰ ਦਾ ਵੀ ਬਹੁਤ ਸ਼ੌਕ ਸੀ ਜਿਸ ਜਿਸਦੇ ਨਾਲ ਮੈਂ ਇੱਕ ਮੂਰਤੀ ਬਣਾਈ ਸੀ ਜੋ ਕਿ ਅੱਜ ਵੀ ਮੇਰੇ ਕਮਰੇ ਵਿੱਚ ਆਪਣੀ ਬਚਪਨ ਦੀ ਯਾਦ ਦੇ ਤੌਰ 'ਤੇ ਪਈ ਹੈ ਜਿਸ ਨੂੰ ਦੇਖ ਕੇ ਮੈਂ ਆਪਣੇ ਬਚਪਨ ਦੀ ਯਾਦ ਕਰਦੀ ਹਾਂ ਅਤੇ ਬਚਪਨ ਦੇ ਵਿੱਚ ਜਦੋਂ ਮੀਂਹ ਪੈਂਦਾ ਸੀ ਉਦੋਂ ਮੈਂ ਕਾਗਜ਼ ਦੀਆਂ ਬਹੁਤ ਸਾਰੀਆਂ ਕਿਸ਼ਤੀਆਂ ਆਪਣੇ ਮਿੱਤਰਾਂ ਨਾਲ ਨਾਲ ਬਣਾ ਕੇ ਪਾਣੀ ਦੇ ਵਿੱਚ ਛੱਡੀਆਂ ਜੋ ਕਿ ਇਹ ਮੇਰੇ ਬਚਪਨ ਦੀਆਂ ਯਾਦਾਂ ਹਨ ਜੋ ਕਿ ਮੈਨੂੰ ਹਮੇਸ਼ਾ ਯਾਦ ਰਹਿਣਗੀਆਂ